ਸਤਿ ਸ਼੍ਰੀ ਅਕਾਲ ਮੇਰੀ ਗੱਲ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਸੱਭਿਆਚਾਰ ਦੀ ਮੈਂ ਗੱਲ ਕਰਾਂ ਜਾਂ ਮੈਂ ਇਸਨੂੰ ਆਪਣੇ ਪੰਜਾਬੀ ਸੱਭਿਆਚਾਰ ਨੂੰ ਦੂਜੇ ਨਾਲ ਆਪਣਾ ਜਿਹੜਾ ਕਲਚਰ ਹੈ ਉਹ ਮੈਂ ਦੱਸਾਂ ਤਾਂ ਮੈਂ ਉਹ ਆਪਣਾ ਕਲਚਰ ਉਹਨਾਂ ਨੂੰ ਦੱਸਾਂਗੀ ਉਹਨਾਂ ਦਾ ਸੁਣਾਂਗੀ ਉਹਨਾਂ ਦਾ ਸੱਭਿਆਚਾਰ ਕੀ ਹੈ ਉਹਨਾਂ ਦਾ ਲੋਕ ਨਾਚ ਕੀ ਹੈ ਸਾਡਾ ਲੋਕ ਨਾਚ ਕੀ ਹੈ ਸਾਡਾ ਫੇਮਸ ਤਿਉਹਾਰ ਕੀ ਹੈ ਅਸੀਂ ਕੀ ਪਸੰਦ ਕਰਦੇ ਹਾਂ ਦੂਜੇ ਸਟੇਟਾਂ ਦੇ ਲੋਕ ਕੀ ਪਸੰਦ ਕਰਦੇ ਆ ਤਾਂ ਉਹਨਾਂ ਦੀ ਜਿਹੜੀ ਅਸੀਂ ਜਦੋਂ ਅਸੀਂ ਇਹ ਦੱਸਾਂਗੇ ਤਾਂ ਪਹਿਲਾਂ ਤਾਂ ਸਾਡੀ ਟਰਾਂਸਲੇਸ਼ਨ ਹੋਵੇਗੀ ਮੈਂ ਉਹਨਾਂ ਦੀ ਭਾਸ਼ਾ ਨੂੰ ਹਿੰਦੀ 'ਚ ਸਮਝੂੰਗੀ ਇੰਗਲਿਸ਼ 'ਚ ਸਮਝੂੰਗੀ ਕਿਉਂਕਿ ਬਾਹਰਲਾ ਬੰਦਾ ਪੰਜਾਬੀ ਨਹੀਂ ਸਮਝ ਪਾਵੇਗਾ ਪਰ ਮੈਂ ਆਪਦਾ ਕਲਚਰ ਜਦੋਂ ਪੰਜਾਬੀ ਜਿਵੇਂ ਅਸੀਂ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਲੱਸੀ ਇਹ ਸਾਡਾ ਪੰਜਾਬੀ ਕਲਚਰ ਆ ਤ੍ਰਿੰਜਣ ਦੀਆਂ ਕੁੜੀਆਂ ਕੁੜੀਆਂ ਦਾ ਇਕੱਠ ਸੱਥ ਇਹ ਕਲਚਰ ਸੱਭਿਆਚਾਰ 'ਚ ਹੀ ਆ ਜਾਂਦਾ ਪੁਰਾਣਾ ਸੱਭਿਆਚਾਰ ਇਹਨੂੰ ਮੈਂ ਅਗਰ ਮੈਂ ਲੋ ਲੋਕ ਨਾਚ ਪੰਜਾਬ ਦਾ ਜੇ ਮੈਂ ਲੁੱਡੀ ਦੀ ਗੱਲ ਕਰਾਂ ਤਾਂ ਇਹ ਪੰਜਾਬ ਦਾ ਵੀ ਹੈ ਹਰਿਆਣਾ ਦਾ ਵੀ ਹੈ ਅਤੇ ਹਿਮਾਚਲ ਦਾ ਪ੍ਰਵੇਸ਼ ਨਾ ਵੀ ਹੈਗਾ ਅਗਰ ਲੁੱਡੀ ਨਾਚ ਦੀ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਇਸਤਰੀ ਲੋਕ ਨਾਚ ਹੈਗਾ ਅਗਰ ਮੈਂ ਇਸ ਤੋਂ ਬਾਹਰ ਜਾਣਨਾ ਚਾਹੁੰਦੇ ਤਾਂ ਜੰਮੂ ਕਸ਼ਮੀਰ ਦਾ ਵੀ ਲੋਕ ਨਾਚ ਹੈ ਉਹ ਅਗਰ ਜਿਸ ਪੰਜਾਬ ਚਲੋ ਚਲੋ ਵੀ ਆਪਾਂ ਕੁਸ਼ਚਨ ਦੀ ਗੱਲ ਕਰੀਏ ਜਦੋਂ ਆਪਾਂ ਨੂੰ ਕੋਈ ਵੀ ਕੁਸ਼ਚਨ ਆਉਂਦਾ ਵੀ ਪੰਜਾਬ ਦੀ ਵੀ ਲੁੱਡੀ ਕਿਸ ਸ ਸਟੇਟ ਦਾ ਨ ਨਾਚ ਹੈ ਜੋ ਆਪਸ਼ਨ ਆ ਗਈ ਵੀ ਜੰਮੂ ਕਸ਼ਮੀਰ ਦਾ ਕੇਰਲ ਦਾ ਆਂਧਰਾਪੁਰ ਦਾ ਪ੍ਰਦੇਸ਼ ਦਾ ਉਹਦੇ ਵਿੱਚ ਪੰਜਾਬ ਨਹੀਂ ਸ਼ੋ ਕਦਾ ਅਗਰ ਪੰਜਾਬ ਸ਼ੋ ਹੁੰਦਾ ਤਾਂ ਪੰਜਾਬ ਹੀ ਰਹੇਗਾ ਨਹੀਂ ਤਾਂ ਜੰਮੂ ਕਸ਼ਮੀਰ ਹੀ ਰਹੇਗਾ ਦੂਜੇ ਸਟੇਟਾਂ ਦੇ ਬਾਰੇ ਮੈਂ ਵੀ ਜਾਣਦੀ ਹਾਂ ਜਿਵੇਂ ਭਾਰਤ ਵਿੱਚ ਕਿੰਨੇ ਲੋਕ ਕਿਹੜੇ ਰਾਜ ਵਿੱਚ ਕਿਹੜਾ ਲੋਕ ਨਾਚ ਹੈ ਕਿਹੜਾ ਤਿਉਹਾਰ ਮਨਾਇਆ ਜਾਂਦਾ ਜਿਵੇਂ ਮੈਂ ਕੱਥਕ ਕਲੀ ਅਤੇ ਕੱਥਕ ਬਾਰੇ ਜਾਣਦੀ ਹਾਂ ਕੱਥਕ ਕਲੀ ਕੇਰਲ ਦਾ ਲੋਕ ਨਾਚ ਹੈ ਉੱਥੇ ਉਨਮ ਤਿਓਹਾਰ ਮਨਾਇਆ ਜਾਂਦਾ ਹੈ ਕੱਥਕ ਹੈ ਜਿਹੜਾ ਉੱਤਰੀ ਭਾਰਤੀ ਦਾ ਲੋਕ ਨਾਚ ਹੈ ਇਸ ਲਈ ਉਹਨਾਂ ਦੇ ਵੀ ਕਲਚਰ ਨੂੰ ਅਸੀਂ ਸਮਝਦੇ ਹਾਂ ਆਪਦੇ ਵੀ ਕਲਚਰ ਨੂੰ ਅਸੀਂ ਸਮਝਦੇ ਹਾਂ ਉਹਨਾਂ ਦੇ ਵੀ ਸੱਭਿਆਚਾਰ ਨੂੰ ਅਸੀਂ ਸੁਣਦੇ ਐਂ ਆਪ ਦੇ ਵੀ ਸੱਭਿਆਚਾਰ ਨੂੰ ਨੇ ਕਿੰਨੇ ਖੇਤਰ ਹੈ ਕਿਹੜੇ ਕਿਹੜੇ ਸਮੂਹ ਵਿੱਚ ਕਿਹੜਾ ਕਿਹੜੀ ਚੀਜ਼ ਕਿਹੜਾ ਮੰਦਰ ਫੇਮਸ ਹੈ ਕਿਹੜਾ ਗੁਰਦੁਆਰਾ ਫੇਮਸ ਹੈ ਕਿਹੜਾ ਕਲਚਰ ਕਿਹੜਾ ਉਹਨਾਂ ਦਾ ਫੇਮਸ ਨਾਚ ਹੈ ਸਾਡਾ ਕੀ ਫੇਮਸ ਹੈ ਅਸੀਂ ਕੀ ਪਸੰਦ ਕਰਦੇ ਹਾਂ ਅਸੀਂ ਆਪਦੇ ਬਾਰੇ ਸਿੰਪਲ ਸੂਟ ਪਾਉਣਾ ਕੁੜਤਾ ਪਜਾਮਾ ਆਪਦੇ ਖਾਣੇ ਬਾਰੇ ਸੱਭਿਆਚਾਰ ਲੋਕ ਪਹਿਰਾਵਾ ਆ ਜਾਂਦਾ ਘਰਾਂ ਬਾਰੇ ਹੋ ਜਾਂਦਾ ਸਾਰਾ ਸੱਭਿਆਚਾਰ ਅਸੀਂ ਦੂਜੇ ਨੂੰ ਦੱਸਦੇ ਹਾਂ ਜਦੋਂ ਵੀ ਦੂਜੇ ਨੂੰ ਦੱਸਦੇ ਹਾਂ ਤਾਂ ਉਹਨਾਂ ਦੀ ਜਿਹੜੀ ਭਾਸ਼ਾ ਜਿਵੇਂ ਮਲਿਆਲਮ ਆਦੀ ਹੋ ਜਾਂਦੀ ਉਹਨੂੰ ਸਮਝਣਾ ਤਾਂ ਔਖਾ ਪਰ ਹਿੰਦੀ ਅਤੇ ਇੰਗਲਿਸ਼ ਰਾਹੀਂ ਅਸੀਂ ਸਮਝ ਸਕਦੇ ਹਾਂ ਸਾਡੇ ਵਿੱਚ ਇਹ ਸੱਭਿਆਚਾਰ ਦੇ ਬਹੁਤ ਵਧੀਆ ਸਮੂਹ ਐਗੇ ਅਸੀਂ ਵੱਧ ਤੋਂ ਵੱਧ ਲੋਕਾਂ ਨਾਲ ਗੱਲ ਕਰਦੇ ਹਾਂ ਅਤੇ ਅਸੀਂ ਉਹਨਾਂ ਨੂੰ ਉੱਨੀ ਹੀ ਜਲਦੀ ਸਮਝਦੇ ਹਾਂ ਅਤੇ ਦੱਸਦੇ ਵੀ ਹਾਂ ਬਹੁਤ ਬਹੁਤ ਧੰਨਵਾਦ